ਅੱਜ ਦੇ ਸਮੇਂ ਦੇ ਵਿੱਚ ਜੋ ਕਿ ਸਾਜ਼ ਵਗੈਰਾ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਲੋਕ ਆਪਣੇ ਘਰਾਂ ਦੇ ਵਿੱਚ ਫੰਕਸ਼ਨ ਕਰਵਾਉਂਦੇ ਹਨ ਵਿਆਹਾਂ ਦੇ ਵਿੱਚ ਜੋ ਵਿਆਹ ਦੇ ਵਿੱਚ ਵਰਤੋਂ ਜਾਂਦਾ ਹੈ ਤਾਂ ਵਿਆਹ ਦੇ ਵਿੱਚ ਸੰਗੀਤ ਰੱਖੇ ਜਾਂਦੇ ਹਨ ਕੁੜੀ ਜਾਂ ਮੁੰਡੇ ਦੇ ਵਿਆਹ ਦੇ ਵਿੱਚ ਤਾਂ ਉਸ ਵਿੱਚ ਢੋਲਕੀ ਵਗੈਰਾ ਦੀ ਵਰਤੋਂ ਕਰਦੇ ਹਨ ਅਤੇ ਉਹ ਆਮ ਤੌਰ 'ਤੇ ਬੱਚਿਆਂ ਅਤੇ ਸਭ ਨੂੰ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵਿਸ਼ਾ ਹੁੰਦਾ ਹੈ ਤਾਂ ਉਸਦੇ ਨਾਲ ਨਾਲ ਉਹਨਾਂ ਨੂੰ ਵਜਾਉਣਾ ਚੰਗੀ ਤਰ੍ਹਾਂ ਹੁੰਦਾ ਹੈ ਇਸਦੇ ਨਾਲ ਨਾਲ ਉਹ ਆਪਣੇ ਸਾਜ਼ ਨੂੰ ਸਾਜ਼ ਸੰਗੀਤ ਨੂੰ ਕਈ ਲੋਕ ਸ਼ੌਂਕ ਨਾਲ ਵਜਾਉਂਦੇ ਹਨ ਅਤੇ ਮੈਨੂੰ ਵੀ ਇਹ ਸ਼ੌਂਕ ਆਪਣੇ ਸਕੂਲ ਤੋਂ ਹੀ ਪਿਆ ਸੀ ਸਾਡੇ ਸਕੂਲ ਦੇ ਵਿੱਚ ਇੱਕ ਵਿਸ਼ਾ ਹੁੰਦਾ ਸੀ ਜਿਸ ਵਿੱਚ ਅਸੀਂ ਹਰਮੋਨੀਅਮਸ ਅਤੇ ਤਬਲਾ ਢੋਲਕੀ ਵਗੈਰਾ ਸਾਨੂੰ ਵਜਾਉਣਾ ਸਿਖਾਉਂਦੇ ਸੀ ਉਸ ਦੇ ਨਾਲ ਨਾਲ ਸਾਨੂੰ ਗਾਉਣਾ ਵੀ ਸਿਖਾਉਂਦੇ ਸੀ ਇਸ ਦੇ ਨਾਲ ਨਾਲ ਮੈਂ ਉਸ ਨੂੰ ਬਹੁਤ ਟਾਈਮ ਤੱਕ ਆਪਣੇ ਸ ਜਿਸ ਜਿਹੜਾ ਟਾਈਮ ਤੱਕ ਮੈਂ ਆਪਣੇ ਸਕੂਲ ਵਿੱਚ ਰਹੀ ਮੈਂ ਇਹ ਵਿਸ਼ਾ ਵਿਸ਼ਾ ਸੀ ਜੋ ਪੀਰੀਅਡ ਸੀ ਮੈਂ ਇਸਨੂੰ ਲਗਾਉਂਦੀ ਸੀ ਦੇ ਮੈਂ ਉਸ ਵਿੱਚੋਂ ਤਬਲਾ ਅਤੇ ਢੋਲਕੀ ਅਤੇ ਹਰਮੋਨੀਅਮ ਵਜਾਉਣਾ ਸਿੱਖਿਆ ਸੀ ਜਿਸ ਦੇ ਨਾਲ ਨਾਲ ਮੈਂ ਜਨ ਗਨ ਮਨ ਦੀ ਪ੍ਰੈਕਟਿਸ ਕਰਦੀ ਹੁੰਦੀ ਸੀ ਉਸਦੇ ਨਾਲ ਨਾਲ ਮੈਂ ਇਸਦੇ ਨਾਲ ਨਾਲ ਮੈਂ ਇੱਕ ਇਸਦੇ ਨਾਲ ਨਾਲ ਮੈਂ ਬਹੁਤ ਜਗ੍ਹਾ 'ਤੇ ਵਿੱਚ ਹਿੱਸਾ ਲਿੱਤਾ ਜਿਸ ਵਿੱਚ ਮੈਨੂੰ ਕਈ ਵਾਰ ਫਸਟ ਫਸਟ ਪ੍ਰਾਈਜ ਮਿਲਦਾ ਰਿਹਾ ਹੈ ਉਸ ਦੇ ਨਾਲ ਨਾਲ ਮੈਂ ਬਹੁਤ ਜ਼ਿਆਦਾ ਸੰਗੀਤ ਵਗੈਰਾ ਵੀ ਬਹੁਤ ਗਾਏ ਪਰ ਇਸ ਨੂੰ ਮੈਂ ਅੱਗੇ ਤੱਕ ਜ਼ਿਆਦਾਤਰ ਨਹੀਂ ਵਧਾ ਸਕੀ ਕਿਉਂਕਿ ਸਕੂਲ ਪੂਰਾ ਹੋਣ ਤੋਂ ਬਾਅਦ ਮੈਂ ਇਸਨੂੰ ਘਰ ਵਿੱਚ ਨਹੀਂ ਵਜਾ ਸਕੀ ਬਸ ਮੈਂ ਇਸ ਨੂੰ ਵਿਆਹ ਸ਼ਾਦੀ ਦੇ ਵਿੱਚ ਜ਼ਿਆਦਾਤਰ ਜਿਵੇਂ ਸਾਡੇ ਘਰਾਂ ਵਿੱਚ ਵਿਆਹ ਹੁੰਦਾ ਸੀ ਤਾਂ ਮੈਂ ਉਸ ਨੂੰ ਢੋਲਕੀ ਨੂੰ ਉਸ ਉਸ ਸਾਜ਼ ਦੀ ਜਗ੍ਹਾ 'ਤੇ ਮੈਂ ਢੋਲਕੀ ਨੂੰ ਵਜਾਉਂਦੀ ਤਾਂ ਮੇਰੇ ਨਾਲ ਜੋ ਸਾਡੇ ਵਿਆਹ ਦੇ ਵਿੱਚ ਰਿਸ਼ਤੇਦਾਰ ਹੁੰਦੇ ਸੀ ਤਾਂ ਉਹ ਕੋਈ ਸੰਗੀਤ ਸੰ ਗਾਂਦੇ ਤਾਂ ਮੈਂ ਉਸ ਤਰ੍ਹਾਂ ਢੋਲਕੀ ਨੂੰ ਵਜਾਦਾ ਜਿਸ ਤਰ੍ਹਾਂ ਦਾ ਉਹਨਾਂ ਨੇ ਸੋਂਗ ਗਾਣਾ ਗਾਣਾ ਹੁੰਦਾ ਸੀਗਾ ਅਤੇ ਉਸਦੇ ਨਾਲ ਮੈਂ ਇਸਨੂੰ ਜ਼ਿਆਦਾ ਅੱਗੇ ਨਹੀਂ ਵਧਾ ਸਕਦੀ ਕਿਉਂਕਿ ਇਸ ਨੂੰ ਸਾਡੇ ਘਰ ਦੇ ਸਾਡੇ ਜੋ ਮਦਰ ਸੀ ਉਹ ਇਸ ਨੂੰ ਚੰਗਾ ਨਹੀਂ ਸਮਝਦੇ ਸੀ ਤਾਂ ਇਸ ਦੇ ਨਾਲ ਨਾਲ ਮੈਂ ਇਸ ਨੂੰ ਸਕੂਲ ਦੇ ਖ਼ਤਮ ਹੋਣ ਦੇ ਦੌਰਾਨ ਹੀ ਮੈਂ ਇਸਨੂੰ ਖ਼ਤਮ ਕਰ ਦਿੱਤਾ ਤਾਂ ਮੈਂ ਇਸ ਤੋਂ ਬਾਅਦ ਉਸ ਤੋਂ ਉਸ ਤੋਂ ਬਾਅਦ ਮੈਂ ਇਸਨੂੰ ਬਿਲਕੁਲ ਕਰਨਾ ਬਿਲਕੁਲ ਬੰਦ ਕਰ ਦਿੱਤਾ ਸੀ ਕਿਉਂਕਿ ਇਸ ਦੇ ਨਾਲ ਸਾਡੇ ਜੋ ਰਿਸ਼ਤੇਦਾਰ ਸੀ ਜਾਂ ਸਾਡੇ ਰਿਸ਼ਤੇਦਾਰਾਂ ਦੇ ਨਾਲ ਨਾਲ ਸਾਡੇ ਘਰ ਦੇ ਸੀ ਉਹ ਕਹਿੰਦੇ ਸੀ ਕਿ ਇਸਤਾ ਨਾਲ ਕੋਈ ਵੀ ਪੈਸ਼ਨ ਨਹੀਂ ਹੈ ਇਸ ਲਈ ਮੈਂ ਉਸਨੂੰ ਬਿਲਕੁਲ ਵਜਾਉਣਾ ਬੰਦ ਕਰਤਾ ਸੀ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੈਂ ਇਸਤੇ ਨਾਲ ਨਾਲ ਮੈਂ ਗਾਇਕੀ ਦਾ ਸ਼ੌਂਕ ਪਾਲਿਆ ਸੀ ਗਾਇਕੀ ਤੋਂ ਬਾਅਦ ਮੈਂ ਗਾਇਕੀ ਨੂੰ ਮੈਂ ਹਾਲੇ ਤੱਕ ਅੱਗੇ ਲੈ ਕੇ ਆਈ ਹਾਂ ਉਸਦੇ ਲਈ ਸਾਡੇ ਘਰ ਦੇ ਨੇ ਕਦੇ ਵੀ ਸਾਨੂੰ ਕੁਛ ਨਹੀਂ ਕਿਹਾ ਜਿਸ ਦੇ ਨਾਲ ਨਾਲ ਮੈਂ ਗਾਇਕੀ ਵੀ ਕੀਤੀ ਅਤੇ ਆਪਣੇ ਨਾਲ ਨਾਲ ਉਸਨੂੰ ਪੜ੍ਹਾਈ ਨੂੰ ਵੀ ਜਾਰੀ ਰੱਖਿਆ ਉਸ ਦੇ ਨਾਲ ਮੈਂ ਪੜ੍ਹਾਈ ਵੀ ਕੀਤੀ ਅਤੇ ਨਾਲ ਪੜ੍ਹਾਈ ਕਰਦੇ ਕਰਦੇ ਮੈਂ ਗਾਈਕੀ ਨੂੰ ਬਹੁਤ ਅੱਗੇ ਤੱਕ ਲੈ ਅਤੇ ਉਸਦੇ ਨਾਲ ਨਾਲ ਬਹੁਤ ਜ਼ਿਆਦਾ ਕਾਮਯਾਬੀ ਹਾਸਲ ਕੀਤੀ ਹੈ